ਹੈਲੋ ਜੀ ਐਮਾਜੋਨ ਤੋਂ ਬੋਲ ਰਹੇ ਆ ਜੀ ਹਾਂਜੀ ਮੈਂ ਨਰੇਸ਼ ਧੌਲ ਪੱਤਰਕਾਰ ਬੋਲ ਰਿਹਾ ਜੀ ਹਾਂਜੀ ਹਾਂਜੀ ਮੈਂ ਪਿਛਲੇ ਦਿਨੀਂ ਤੁਹਾਡੇ ਤੋਂ ਇੱਕ ਔਡਰ ਕੀਤਾ ਸੀਗਾ ਹੈਡਫੋਨ ਜੀ ਹਾਂ ਉਹ ਮੇਰੇ ਕੋਲ ਪਹੁੰਚ ਗਿਆ ਜੀ ਅਤੇ ਬਹੁਤ ਘੱਟ ਕੀਮਤ 'ਤੇ ਸੀਗਾ ਜੀ ਮੈਂ ਮਾਰਕੀਟ 'ਚ ਵੀ ਪਤਾ ਕੀਤਾ ਅਤੇ ਉਹਦੇ ਨਾਲੋਂ ਬਹੁਤ ਘੱਟ ਕੀਮਤ ਸੀਗੀ ਅਤੇ ਵਰਤੋਂ ਕਰਕੇ ਹੁਣ ਬਹੁਤ ਵਧੀਆ ਲੱਗਿਆ ਬਹੁਤ ਅ ਵਧੀਆ ਕੁਆਲਟੀ ਦਾ ਸੀਗਾ ਜੀ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਅੱਗੇ ਨੂੰ ਵੀ ਤੁਹਾਨੂੰ ਅਸੀਂ ਔਡਰ ਕਰਾਂਗੇ ਅਤੇ ਆਸ ਕਰਦੇ ਹਾਂ ਕਿ ਵੀ ਅੱਗੇ ਨੂੰ ਵੀ ਤੁਸੀਂ ਵਧੀਆ ਸਮਾਨ ਸਾਨੂੰ ਇਸੇ ਤਰ੍ਹਾਂ ਭੇਜਦੇ ਰਹੋਂਗੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ